ਵੀਹ ਅਗਸਤ ਦੋ ਹਜ਼ਾਰ ਪੰਜ ਸੱਤ ਦਸੰਬਰ ਦੋ ਹਜ਼ਾਰ ਦੋ ਪੱਚੀ ਜੁਲਾਈ ਦੋ ਹਜ਼ਾਰ ਬਾਰ੍ਹਾਂ ਤੇਰ੍ਹਾਂ ਮਾਰਚ ਦੋ ਹਜ਼ਾਰ ਤਿੰਨ ਸੱਤ ਨਵੰਬਰ ਦੋ ਹਜ਼ਾਰ ਦੋ